ਮੈਨੂੰ ਸਿਲਾਈ ਅਤੇ ਬੁਣਾਈ ਦੀ ਦਿਲਚਸਪੀ ਕਾਫੀ ਸਮੇਂ ਤੋਂ ਸੀ ਮੈਨੂੰ ਦਸਵੀਂ ਪਾਸ ਕਰਨ ਤੋਂ ਬਾਅਦ ਹੀ ਮੈਨੂੰ ਫੈਸ਼ਨ ਡਿਜ਼ਾਇਨਿੰਗ ਦਾ ਇੱਕ ਸੁਝਾਵ ਮਿਲਿਆ ਅਤੇ ਮੈਂ ਆਪਣੀ ਗ੍ਰੈਜੂਏਸ਼ਨ ਤੱਕ ਦਾ ਮੈਂ ਸਿਰਫ ਫੈਸ਼ਨ ਡਿਜ਼ਾਇਨਿੰਗ ਦੇ ਵਿੱਚ ਹੀ ਕੀਤੀ ਫੈਸ਼ਨ ਡਿਜ਼ਾਇਨਿੰਗ ਕਰਨ ਦੇ ਨਾਲ ਮੈਨੂੰ ਕਾਫੀ ਲਾਈਨਾਂ ਮੇਰੇ ਲਈ ਖੁੱਲ੍ਹ ਗਈਆਂ ਜਿਸ ਤਰ੍ਹਾਂ ਬੁਟੀਕ ਲੁਧਿਆਣੇ ਵਿੱਚ ਜਿਸ ਤਰ੍ਹਾਂ ਫੈਬਰਿਕ ਇੰਡਸਟਰੀ ਹੈਗੀ ਹੈ ਗਾਰਮੈਂਟ ਇੰਡਸਟਰੀ ਹੈਗੀ ਹੈ ਉਹਦੇ ਵਿੱਚ ਸਾਨੂੰ ਅੱਛੇ ਰੈਂਕ 'ਤੇ ਜੋਬ ਮਿਲ ਜਾਂਦੀ ਹੈ ਔਰ ਅਸੀਂ ਕਾਫੀ ਵਧੀਆ ਰੈਂਕ 'ਤੇ ਔਰ ਉਸ ਰੈਂਕ ਦੇ ਹਿਸਾਬ ਨਾਲ ਸਾਨੂੰ ਜੋ ਸਾਡਾ ਅਰਨ ਹੈ ਸਾਡੀ ਆਮਦਨੀ ਹੈ ਵਧੀਆ ਤਰੀਕੇ ਦੇ ਨਾਲ ਮਿਲ ਸਕਦੀ ਹੈ ਅਤੇ ਹੁਣ ਮੈਂ ਜਿਸ ਤਰ੍ਹਾਂ ਬੁਟੀਕ ਦਾ ਕੰਮ ਕਰਦੀ ਹਾਂ ਅਤੇ ਇਹਦੇ ਵਿੱਚ ਲੋਕਾਂ ਨੂੰ ਮੇਰਾ ਕੰਮ ਬੜਾ ਪਸੰਦ ਆਉਂਦਾ ਹੈ ਅਤੇ ਉਹ ਕੰਮ ਦੀ ਮੇਰੀ ਪ੍ਰੇਸ ਕਰਦੇ ਹੈ ਜਿਨ੍ਹਾਂ ਤੋਂ ਮੈਨੂੰ ਕਾਫੀ ਪ੍ਰੇਰਣਾ ਮਿਲਦੀ ਹੈ ਹੋਰ ਕੰਮ ਵਧੀਆ ਕਰਨ ਦੀ ਅਤੇ ਮੈਨੂੰ ਇਹਦੇ ਵਿੱਚ ਕਾਫੀ ਦਿਲਚਸਪੀ ਰਹਿੰਦੀ ਹੈ ਲੋਕ ਵੀ ਦਿਲਚਸਪੀ ਲੈਂਦੇ ਨੇ ਕਿਉਂਕਿ ਇਹ ਕੰਮ ਹੀ ਇਸ ਤਰ੍ਹਾਂ ਦਾ ਹੈ ਕਰੀਏਸ਼ਨ ਦਾ ਜੋ ਕਿ ਬਹੁਤ ਮਜ਼ੇ ਵਾਲਾ ਕੰਮ ਹੈ ਧੰਨਵਾਦ